ਇੰਟਰਨੈੱਟ ਦਾ ਪ੍ਰਭਾਵ ਦਿਨੋਂ ਦਿਨ ਪ੍ਰਤੀ ਵਧਦਾ ਜਾ ਰਿਹਾ ਹੈ ਸਾਡੇ ਜੀਵਨ ਵਿੱਚ ਸਾਡੇ ਲਈ ਜਾਣਕਾਰੀ ਅਤੇ ਸੰਚਾਰ ਇੱਕ ਦੁਨੀਆਂ ਖੋਲ੍ਹ ਦਿੱਤੀ ਹੈ ਇਸ ਦੇ ਦਰ ਦੀ ਮਹੱਤਤਾ ਧਿਆਨ 'ਚ ਰੱਖਦੇ ਹੋਏ ਇੰਟਰਨੈੱਟ ਬਿਨਾਂ ਦੁਨੀਆਂ ਦਾ ਵਰਤਮਾਨ ਕਲਪਨਾ ਕਰਨਾ ਮੁਸ਼ਕਲ ਹੈ ਇਹ ਕਦੇ ਖਤਮ ਹੋਣ ਵਾਲੀ ਨਵੀਨਤਾ ਜਾਂ ਰਚਨਾਤਮਕ ਪ੍ਰਭਾਵਤਵ ਨਹੀਂ ਇੰਟਰਨੈੱਟ ਨੂੰ ਆਮ ਤੌਰ 'ਤੇ ਨੈੱਟ ਵੀ ਕਿਹਾ ਜਾਂਦਾ ਉਮਰ ਦੇ ਪੇਸ਼ੇ ਵਿੱਚ ਦੇ ਲੋਕਾਂ ਲਈ ਇੱਕ ਵੱਡੀ ਆਰਥਿਕ ਸੰਭਾਵਨਾ ਲਿਆ ਹੈ ਰਪੋਟ ਅਨੁਸਾਰ ਪੂਰੀ ਦੁਨੀਆਂ ਵਿੱਚ ਲਗਭਗ ਪੰਜ ਅਰਬ ਨਾਲ ਇੰਟਰਨੈੱਟ ਸੰਚਾਰ ਦੇ ਸਭ ਤੋਂ ਮਹੱਤਵਪੂਰਨ ਸਾਧਨਾਂ ਵਜੋਂ ਉੱਭਰ ਰਿਹਾ ਹੈ ਇੰਟਰਨੈੱਟ ਜ਼ਿੰਦਗੀ ਦਾ ਪ੍ਰਭਾਵ ਸਾਡਾ ਜਦੋਂ ਕਿ ਇੰਟਰਨੈੱਟ ਦੀ ਸਥਾਪਨਾ ਕੀਤੀ ਗਈ ਸੀ ਸਾਡੀਆਂ ਉਂਗਲੀਆਂ 'ਤੇ ਜਾਣਕਾਰੀ ਅਤੇ ਗਿਆਨ ਨੂੰ ਲੈ ਕੇ ਇੰਟਰਨੈੱਟ ਅਜੋਕੇ ਸਮੇਂ ਵਿੱਚ ਸਭ ਤੋਂ ਉਪਯੋਗੀ ਤਕਨੋਲਜੀ ਹੈ ਵਿਸ਼ਵ ਪੱਧਰ ਦੇ ਆਪਸ ਵਿੱਚ ਜੁੜੇ ਹੋਏ ਕੰਪਿਊਟਰ ਨੈੱਟਵਰਕ ਹਨ ਜਿਹੜੇ ਦੁਨੀਆਂ ਭਰ ਦੇ ਅਰਬਾਂ ਉਪਭੋਗਤਾ ਦੀ ਸੇਵਾ ਲਈ ਉਪਕਰਨਾਂ ਨੂੰ ਜੋੜਨ ਵਿੱਚ ਇੰਟਰਨੈੱਟ ਦੀ ਵਰਤੋਂ ਕਰਦੇ ਹਨ ਸੰਖੇਪ ਵਿੱਚ ਇੰਟਰਨੈੱਟ ਇੱਕ ਆਪਟੀਕਲ ਫਾਈਬਰ ਕੇਬਲਾਂ ਦਾ ਜਾਲ ਹੈ ਜ਼ਮੀਨ ਅਤੇ ਸਮੁੰਦਰ ਵਿੱਚ ਵਿਛੀਆਂ ਹੋਈਆਂ ਹਨ ਵੱਖ ਵੱਖ ਸੇਵਾਵਾਂ ਦੇਣ ਵਾਲੀਆਂ ਕੰਪਨੀਆਂ ਦਾ ਡਾਟਾ ਸੈਂਟਰ ਕੰਪਿਊਟਰ ਅਤੇ ਮੋਬਾਇਲ ਫੋਨ ਆਪਸ ਵਿੱਚ ਜੁੜੇ ਹੁੰਦੇ ਹਨ ਗਲੋਬਲ ਵਜੋਂ ਜਾਣਿਆ ਜਾਂਦਾ ਹੈ ਇਹ ਪਰਿਭਾਸ਼ਾ ਇੰਟਰਨੈੱਟ ਦੀ ਮਹੱਤਤਾ ਦੇ ਆਪ ਮੁਹਾਰੇ ਸਪਸ਼ਟ ਕਰਦੀ ਹੈ ਇੱਕ ਬਟਣ ਦੱਬਣ ਕਲਿੱਕ ਨਾਲ ਵਿਸ਼ਵ ਵਿਆਪੀ ਵਿਅਕਤੀ ਨੂੰ ਜੋੜਨ ਦੀ ਗੱਲ ਆਉਂਦੀ ਹੈ ਇੰਟਰਨੈੱਟ ਕੁਨੈਕਸ਼ਨਾਂ ਤੋਂ ਬਿਨਾਂ ਆਪਣੀ ਜ਼ਿੰਦਗੀ ਦੀ ਕਲਪਨਾ ਕਰ ਸਕਦੇ ਹੋ ਮੈਨੂੰ ਲੱਗਦਾ ਨਹੀਂ ਵਰਤਮਾਨ ਸਮੇਂ ਵਿੱਚ ਸਰਵਿਸ ਦੇ ਨਾਲ ਸ਼ਬਦ ਜੁੜ ਰਿਹਾ ਹੈ ਭਾਵ ਇੰਟਰਨੈੱਟ ਉੱਪਰ ਮਿਲਣ ਵਾਲੀ ਸੇਵਾ ਇਨ੍ਹਾਂ ਸਾਰੀਆਂ ਬਹੁ ਪੱਖੀ ਸੇਵਾਵਾਂ ਮੱਦੇਨਜ਼ਰ ਕੌਮਾਂਤਰੀ ਇੰਟਰਨੈੱਟ ਪੂਰੀ ਦੁਨੀਆਂ ਵਿੱਚ ਉਨੱਤੀ ਅਕਤੂਬਰ ਨੂੰ ਹਰ ਸਾਲ ਬੜੀ ਸਿਦਕ ਨਾਲ ਮਨਾਇਆ ਜਾਂਦਾ ਹੈ ਦਿਨ ਹੀ ਕੰਪਊਟਰ ਨੈੱਟਵਰਕ ਉੱਪਰ ਪਹਿਲਾਂ ਸਨੇਹਾਂ ਇੱਕ ਕੰਪਊਟਰ ਤੋਂ ਦੂਜੇ ਕੰਪਊਟਰ ਉੱਪਰ ਭੇਜਿਆ ਗਿਆ ਸੀ ਸਾਲ ਦੋ ਹਜ਼ਾਰ ਪੰਜ ਤੋਂ ਦਿਨ ਨੂੰ ਕਈ ਵਾਰ